ਜੇਕਰ ਖਿਆਲ ਵਿੱਚ ਰਾਜ ਬਾਰੇ ਦੀ ਗੱਲ ਕੀਤੀ ਜਾਵੇ ਤਾਂ ਜਿਵੇਂ ਕਿ ਮੈਂ ਪੰਜਾਬ ਰਾਜ ਦੇ ਜ਼ਿਲ੍ਹੇ ਨਵਾਂਸ਼ਹਿਰ ਵਿੱਚ ਰਹਿਣ ਵਾਲੀ ਹਾਂ ਇੱਥੇ ਸਾਰੇ ਹੀ ਜ਼ਿਆਦਾਤਰ ਪੰਜਾਬੀ ਬੋਲਦੇ ਹਨ ਅਤੇ ਜਿੰਨੇ ਵੀ ਪੰਜਾਬੀ ਜਾਂ ਪੰਜਾਬ ਦੇ ਵਾਸੀ ਹੁੰਦੇ ਆਂ ਉਹ ਸਾਰੇ ਹੀ ਲਗਭਗ ਪੰਜਾਬੀ ਬੋਲਦੇ ਅਤੇ ਪੰਜਾਬੀ ਬੋਲਣ ਦੇ ਨਾਲ ਨਾਲ ਉਹ ਆਪਣੇ ਜਿਹੜੇ ਆ ਪੰਜਾਬ ਦੇ ਸੱਭਿਆਚਾਰ ਜਿਹੜੇ ਤਿਉਹਾਰ ਉਹ ਬਹੁਤ ਵਧੀਆ ਢੰਗ ਨਾਲ ਮਨਾਉਂਦੇ ਹਾਂ